ਮੈਂ ਜਦੋਂ ਸਕੂਲ 'ਚ ਹੁੰਦਾ ਸੀ ਉਦੋਂ ਨੌਵੀਂ ਕਲਾਸ 'ਚ ਸੀਗਾ ਉਦੋਂ ਸਾਡੇ ਸਕੂਲ 'ਚ ਕੌਪਟੀਸ਼ਨ ਕਰਵਾਇਆ ਸੀ ਰਨਿੰਗ ਕੌਪਟੀਸ਼ਨ ਅਤੇ ਅਪ ਸਾਡੀ ਕਲਾਸ ਦੇ ਦਸ ਬਾਰ੍ਹਾਂ ਮੁੰਡਿਆਂ ਨੇ ਪਾਰਟੀਸਿਪੇਟ ਕੀਤਾ ਸੀ ਅਤੇ ਮੈਂ ਵੀ ਕੀਤਾ ਸੀ ਪਾਰਟੀਸਿਪੇਟ ਪਹਿਲੀ ਵਾਰ ਮੈਂ ਕਿਸੇ 'ਚ ਪਾਰਟੀਸਿਪੇਟ ਕੀਤਾ ਅਤੇ ਜਦੋਂ ਰਨਿੰਗ ਰਨਿੰਗ ਵਾਲੇ ਦਿਨ ਜਦੋਂ ਰਨਿੰਗ ਕੀਤੀ ਆਪਾਂ ਜਦੋਂ ਆਪਾਂ ਭੱਜੇ ਤਾਂ ਫਿਰ ਮੈਂ ਕਾਫੀ ਪਿੱਛੇ ਸੀ ਅਤੇ ਸ਼ੁਰੂ ਸ਼ੁਰੂ 'ਚ ਕਾਫੀ ਪਿੱਛੇ ਸੀ ਮੈਂ ਅਤੇ ਉਸ ਤੋਂ ਬਾਅਦ ਮੈਂ

ਅਤੇ ਉਹ ਨੰਗਾ ਹੋ ਗਿਆ ਅਤੇ ਜਿੰਨੇ ਵੀ ਸਾ ਸੀਗੇ ਸਾਰੇ ਜਣੇ ਔਫਿਸਰ ਵਗੈਰਾ ਮੁੰਡੇ ਸਨ ਸਾਰੇ ਦੇਖਕੇ ਹੱਸਣ ਲੱਗ ਪਏ ਅਤੇ ਇੱਕ ਵਾਰ ਜਦੋਂ ਆਪਾਂ ਆਰਮੀ ਦੀ ਪ੍ਰੈਕਟਿਸ ਕਰਦੇ ਸੀ ਜਦੋਂ ਮੈਂ ਸੋਲ੍ਹਾਂ ਸਤਾਰਾਂ ਸਾਲ ਦਾ ਸੀ ਰਨਿੰਗ ਦੀ ਪ੍ਰੈਕਟਿਸ ਕਰਦੇ ਸੀ ਆਰਮੀ 'ਚ ਭਰਤੀ ਹੋਣ ਲਈ ਉਦੋਂ ਆਪਾਂ ਤਿੰਨ ਚਾਰ ਜਣੇ ਹੁੰਦੇ ਸੀਗੇ ਸਵੇਰੇ ਸਵੇਰੇ ਦੋੜ ਲਾਉਣ ਜਾਂਦੇ ਹੁੰਦੇ ਸੀ ਅਤੇ ਤਾਂ ਆਪਾਂ ਦੋ ਕੁ ਜਣੇ ਸਵੇਰੇ ਸਵੇਰੇ ਗਏ ਆਪਣੇ ਦੂਸਰੇ ਦੋਸਤ ਨੂੰ ਬੁਲਾਉਣ ਇਹ ਕਹਿ ਰਿਹਾ ਆਪਾਂ ਚਲਦੇ ਹਾਂ ਰਨਿੰਗ 'ਤੇ ਪਰ ਜਦੋਂ ਦੇਖਿਆ ਤਾਂ ਉਹ ਜਦੋਂ ਆਪਾਂ ਉਹਦੇ ਘਰ ਪਹੁੰਚੇ ਤਾਂ ਦੇਖਿਆ ਤਾਂ ਖੁਰਲੀ 'ਚ ਪਿਆ ਹੋਇਆ ਸੀ ਅਤੇ ਉਹ ਆਪਾਂ ਸੋਚਦੇ ਪਤਾ ਨਹੀਂ ਸਾਰੀ ਰਾਤ ਖੁਰਲੀ 'ਚ ਕਾਹਤੋਂ ਪਿਆ ਹੋਇਆ ਸੀ ਉਹ ਵੀ ਆਪਾਂ ਸੋਚ ਸੋਚ ਕੇ ਕਦੇ ਕਦੇ ਹੱਸਦੇ ਹਾਂ